ਪੰਜਾਬ ਨੂੰ ਕੋਈ ਵੀ ਸਮੁੰਦਰੀ ਤੱਟ ਨਹੀਂ ਲੱਗਦਾ ਇਸ ਲਈ ਇੱਥੇ ਕੋਈ ਬੀਚ ਤਾਂ ਨਹੀਂ ਹੈ ਔਰ ਬੀਚ ਨਾ ਹੋਣ ਕਰਕੇ ਇੱਥੇ ਸੈਲਾਨੀ ਤੈਰਾਕੀ ਦੀਆਂ ਖੇਡਾਂ ਤਾਂ ਨਹੀਂ ਕਰਵਾਈ ਜਾਂਦੀਆਂ ਪਰ ਪਾਣੀ ਦੀਆਂ ਖੇਡਾਂ ਜਿਵੇਂ ਕਿ ਤੈਰਾਕੀ ਆਦਿ ਕਰਵਾਉਣ ਲਈ ਇੱਥੇ ਲੋਕਲ ਸਵੀਮਿੰਗ ਪੂਲ ਹਨ ਲਗਭਗ ਹਰ ਜਿਲ੍ਹੇ ਵਿੱਚ ਹੀ ਇਨਡੋਰ ਜਾਂ ਆਊਟਡੋਰ ਸਵੀਮਿੰਗ ਪੂਲ ਬਣੇ ਹੋਏ ਹਨ ਜਿੱਥੇ ਕਿ ਵੱਖ ਵੱਖ ਤਰ੍ਹਾਂ ਦੀਆਂ ਤੈਰਾਕੀ ਦੀਆਂ ਖੇਡਾਂ ਸਕੂਲ ਪੱਧਰੀ ਜਾਂ ਇਨਵੈਸਟੀ ਪੱਧਰ 'ਤੇ ਕਰਵਾਈਆਂ ਜਾਂਦੀਆਂ ਹਨ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ ਇੱਥੇ ਲਗਭਗ ਹਰ ਗੁਰਦੁਆਰੇ ਵਿੱਚ ਸਰੋਵਰ ਹੁੰਦਾ ਹੈ ਜਿੱਥੇ ਕਿ ਬਾਹਰੋਂ ਸ਼ਰਧਾਲੂ ਜਾਂ ਯਾਤਰੂ ਆ ਕੇ ਇਸ਼ਨਾਨ ਕਰਦੇ ਹਨ ਜੇ ਅਸੀਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜਿਲ੍ਹੇ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ ਔਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਜਿਸਨੂੰ ਪੁਰਾਣੇ ਸਮੇਂ ਵਿੱਚ ਸ਼੍ਰੀ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਸੀਗਾ ਇਹ ਤਾਂ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ਇਹ ਗੁਰਦੁਆਰਾ ਸਰੋਵਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੇ ਗੁਰਦੁਆਰੇ ਹਨ ਲਗਭਗ ਸਾਰੇ ਗੁਰਦੁਆਰਿਆਂ ਵਿੱਚ ਹੀ ਸਰੋਵਰ ਹੁੰਦਾ ਹੈ ਜਿੱਥੇ ਕਿ ਸ਼ਰਧਾਲੂ ਇਸ਼ਨਾਨ ਕਰਦੇ ਹਨ ਇਹਨਾਂ ਨੂੰ ਅਸੀਂ ਸਪਿਰਚੁਅਲ ਸਰੋਵਰ ਜਾਂ ਹੋਲੀ ਬਾਥ ਤਾਂ ਕਹਿ ਦਿੰਦੇ ਹਾਂ ਬਟ ਇਸਨੂੰ ਆਪਾਂ ਖੇਡਾਂ ਨਹੀਂ ਕਹਿ ਕਹਿ ਸਕਦੇ